ਪੰਜਾਬੀ ਭਾਸ਼ਾ ਦੀਆਂ ਬਹੁਤ ਹੀ ਵਿਲੱਖਣ ਵਿਸ਼ੇਸ਼ਤਾਵਾਂ ਹਨ ਜੋ ਕਿ ਮੈਨੂੰ ਬਹੁਤ ਹੀ ਜ਼ਿਆਦਾ ਦਿਲਚਸਪ ਲੱਗਦੀਆਂ ਹਨ ਜਿਵੇਂ ਕਿ ਅੰਗਰੇਜ਼ੀ ਵਿੱਚ ਅਲਫਾਬੈਟਸ ਹੁੰਦੇ ਨੇ ਉਹ ਛੱਬੀ ਹੁੰਦੇ ਨੇ ਅਤੇ ਇਹ ਸਾਡੇ ਪੰਜਾਬੀ ਵਿੱਚ ਅੱਖਰ ਹੁੰਦੇ ਨੇ ਜਿਹਨਾਂ ਦੀ ਵੱਖ ਵੱਖ ਵੱਖ ਵੱਖ ਤਰੀਕਿਆਂ ਨਾਲ ਵੱਖ ਵੱਖ ਟੋਨ ਨਿਕਲਦੀ ਹੈ ਅਤੇ ਜਿੱਦਾਂ ਇੰਗਲਿਸ਼ ਵਿੱਚ ਅੰਗਰੇਜੀ ਵਿੱਚ ਇੱਦਾਂ ਦਾ ਕੋਈ ਨਹੀਂ ਹੁੰਦਾ ਜਿਵੇਂ ਸਾਡੇ ਪੰਜਾਬੀ 'ਚ ਹੁੰਦੇ ਆ ਚਾਚਾ ਚਾਚੀ ਮਾਮਾ ਮਾਮੀ ਮਾਸੀ ਮਾਸੜ ਭੂਆ ਫੁੱਫੜ ਅਤੇ ਉਵੇਂ ਹੀ ਅੰਗਰੇਜ਼ੀ ਵਿੱਚ ਅਸੀਂ ਸਿਰਫ ਅੰਕਲ ਆਂਟੀ ਹੁੰਦਾ ਹੈ ਜਿਸ ਨਾਲ ਮਤਲਬ ਬੋਲਣ 'ਚ ਵੀ ਬਹੁਤ ਹੀ ਅਜੀਬ ਜਿਹਾ ਲੱਗਦਾ ਹੈ ਸਾਡੀ ਪੰਜਾਬੀ ਭਾਸ਼ਾ ਬਹੁਤ ਹੀ ਜ਼ਿਆਦਾ ਦਿਲਚਸਪ ਹੈ ਸਾਡੀ ਮਾਂ ਬੋਲੀ ਪੰਜਾਬੀ ਹੈ ਅਸੀਂ ਜੱਦ ਪੰਜਾਬੀ ਭਾਸ਼ਾ ਬੋਲਦੇ ਹਾਂ ਤਾਂ ਇੱਕ ਵੱਖਰਾ ਹੀ ਸਕੂਨ ਮਿਲਦਾ ਹੈ ਜੋ ਕਿ ਸਾਨੂੰ ਇੰਗਲਿਸ਼ ਬੋਲਦੇ ਸਮੇਂ ਅੰਗਰੇਜ਼ੀ ਬੋਲਦੇ ਸਮੇਂ ਬਿਲਕੁਲ ਵੀ ਨਹੀਂ ਮਿਲਦਾ ਇਸ ਕਰਕੇ ਸਾਡੀ ਮਾਂ ਬੋਲੀ ਪੰਜਾਬੀ ਹੈ ਉਸ ਦੀ ਬਹੁਤ ਹੀ ਜ਼ਿਆਦਾ ਵਿਸ਼ੇਸ਼ਤਾਵਾਂ ਹਨ ਅਤੇ ਸਾਨੂੰ ਵੱਧ ਤੋਂ ਵੱਧ ਜ਼ਿਆਦਾ ਪੰਜਾਬੀ ਦਾ ਪ੍ਰਯੋਗ ਕਰਨਾ ਚਾਹੀਦਾ ਹੈ